ਹਾਂ ਮੈਂ ਕਿਸਾਨਾਂ ਦੇ ਹਾਲਾਤ ਬਾਰੇ ਕੁਛ ਕਹਿਣਾ ਚਾਹੁੰਦੀ ਹਾਂ ਜੋ ਕਿਸਾਨ ਫਸਲਾਂ ਖਰਾਬ ਕਰਕੇ ਸੁਸਾਈਡ ਕਰ ਲੈਂਦੇ ਹੈ ਉਹਨਾਂ ਦੀ ਫੈਮਲੀ ਨੂੰ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਅਤੇ ਉਹਨਾਂ ਦੀ ਫੈਮਿਲੀ ਨੂੰ ਅੱਗੇ ਸਰਵਾਈਵ ਕਰਨਾ ਵੀ ਬਹੁਤ ਔਖਾ ਹੋ ਜਾਂਦਾ ਹੈ ਕਿਸਾਨਾਂ ਦੀਆਂ ਜਦੋਂ ਫਸਲਾਂ ਖਰਾਬ ਹੁੰਦੀਆਂ ਹਨ ਤਾਂ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਉਹਨਾਂ ਨੇ ਇਸ ਫਸਲਾਂ ਨੂੰ ਉਗਾਉਣ ਲਈ ਬੀਜਾਂ ਲਈ ਅਤੇ ਬਹੁਤ ਪੈਸੇ ਲੋਨ ਚੱਕੇ ਹੁੰਦੇ ਹਨ ਅਤੇ ਇੱਕ ਫਸਲਾਂ ਖਰਾਬ ਹੋਣ ਕਰਕੇ ਉਹ ਇਹ ਲੋਨ ਨੂੰ ਵੀ ਨਹੀਂ ਚੁਕਾ ਸਕਦੇ ਅਤੇ ਇਹ ਲੋਨ ਉਹਨਾਂ ਨੇ ਬਹੁਤ ਹੀ ਮਹਿੰਗੀਆਂ ਕਿਸ਼ਤਾਂ 'ਤੇ ਲਏ ਹੁੰਦੇ ਹਨ ਅਤੇ ਉਹ ਇਹ ਕਿਸ਼ਤ ਲੋਨ ਇਸੇ ਕਰਕੇ ਉਮੀਦ 'ਤੇ ਲੈਂਦੇ ਹੈ ਤਾਂ ਕਿ ਫਸਲਾਂ ਵਧੀਆਂ ਹੋਣ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਪੈਸੇ ਮਿਲਣ ਤਾਂ ਜੋ ਇਹ ਉਹ ਲੋਨ ਚੁਕਾ ਸਕਣ ਪਰ ਜਦੋਂ ਕੁਝ ਕਾਰਨ ਕਰਕੇ ਫਸਲਾਂ ਖਰਾਬ ਹੋ ਜਾਂਦੀਆਂ ਹਨ ਜਿਵੇਂ ਕਿ ਬਿਨ ਮੌਸਮ ਬਰਸਾਤ ਕਰਕੇ ਫਸਲਾਂ ਖਰਾਬ ਹੋ ਜਾਂਦੀਆਂ ਹਨ ਮੀਂਹ ਪੈਣ ਕਰਕੇ ਜਾਂ ਇਨ ਹੋਰ ਹੋਰ ਇਨਸੈਕਟਸ ਦੇ ਅਟੈਕ ਕਰਕੇ ਜਿਸ ਨਾਲ ਫਸਲਾਂ ਖਰਾਬ ਹੁੰਦੀਆਂ ਹਨ ਪਰ ਗੌਰਮੈਂਟ ਉਹਨਾਂ ਨੂੰ ਕੁਝ ਹੈਲਪ ਨਹੀਂ ਕਰਦੀ ਜਿਸ ਕਰਕੇ ਉਹ ਸੁਸਾਈਡ ਕਰਦੇ ਹਨ ਅਤੇ ਉਹਨਾਂ ਦੀ ਫੈਮਲੀ ਵੀ ਬਹੁਤ ਔਖੀ ਹੁੰਦੀ ਹੈ ਗੌਰਮੈਂਟ ਨੂੰ ਇਸ ਲਈ ਬਹੁਤ ਕੰਮ ਕਰਨੇ ਚਾਹੀਦੇ ਹਨ ਤਾਂ ਗੌਰਮੈਂਟ ਨੂੰ ਉਹਨਾਂ ਨੂੰ ਲੋਨ ਵੀ ਉਤਾਰਨ ਲਈ ਉਹਨਾਂ ਨੂੰ ਕੁਛ ਪੈਸੇ ਦੇਣੇ ਚਾਹੀਦੇ ਹਨ ਤਾਂ ਜੋ ਉਸ ਲੋਨ ਨੂੰ ਚੁਕਾਉਣ ਨਾ ਕਰਕੇ ਸੁਸਾਈਡ ਕਰਦੇ ਹਨ ਉਹ ਇਹ ਸੁਸਾਈਡ ਨਾ ਕਰਨ ਅਤੇ ਉਹਨਾਂ ਦੀ ਫੈਮਿਲੀ ਨੂੰ ਵੀ ਪ੍ਰੋਬਲਮ ਨਾ ਆਏ ਗੌਰਮੈਂਟ ਨੂੰ ਕਿਸਾਨਾਂ ਦੀਆਂ ਫਸਲਾਂ ਸਸਤੀ ਨਹੀਂ ਕਰਨੀ ਚਾਹੀਦੀ ਟੈਕਸ ਨਹੀਂ ਲਗਾਉਣਾ ਚਾਹੀਦਾ ਕਿਸਾਨਾਂ 'ਤੇ ਤਾਂ ਜੋ ਕਿਸਾਨ ਆਪਣੇ ਜ਼ਿੰਦਗੀ ਈਜ਼ੀਲੀ ਰਹਿ ਸਕਣ ਅਤੇ ਉਹਨਾਂ ਦਾ ਪਰਿਵਾਰ ਵੀ ਬਹੁਤ ਖੁਸ਼ ਰਹਿ ਸਕੇ